ਮੋਹਾਲੀ ਜ਼ਿਲ੍ਹੇ ਸਥਾਨਕ ਸਿੱਖਿਆ ਜਾਂ ਸਿੱਖਣ ਦੇ ਮੌਕੇ ਬਹੁਤ ਵਧੀਆ ਹਨ ਜਿਸ ਦਾ ਬਹੁਤ ਵਧੀਆ ਵਿਕਾਸ ਹੋਇਆ ਹੈ ਅਤੇ ਇਸ ਵਿੱਚ ਜੋ ਵੀ ਵਿਕਾਸ ਹੋਇਆ ਹੈ ਉਹ ਮੋਹਾਲੀ ਜ਼ਿਲ੍ਹਿਆਂ ਦੇ ਇਹ ਇਹ ਜਿੰਨੇ ਵੀ ਨੇ ਉਹਨਾਂ ਨੇ ਆਪਣਾ ਬਹੁਤ ਬਹੁਤ ਯੋਗਦਾਨ ਪਾਇਆ ਹੈ ਅਤੇ ਇਹਨਾਂ ਦੇ ਬਹੁਤ ਜਿਆਦਾ ਪ੍ਰਸਿੱਧ ਕੋਚਿੰਗ ਸੈਂਟਰ ਅਤੇ ਕਲਾਸਾਂ ਹਨ ਜਿਹਨਾਂ ਨੇ ਵੀ ਸਰਕਾਰੀ ਸਕੂਲ ਜਿੰਨੇ ਵੀ ਸਾਰੇ ਸਰਕਾਰੀ ਸਕੂਲ ਹਨ ਉਹਨਾਂ ਉਹਨਾਂ ਨੇ ਉਹ ਸਰਕਾਰੀ ਸਕੂਲ ਵੀ ਬਹੁਤ ਵਧੀਆ ਹਨ ਅਤੇ ਜਿਨ੍ਹਾਂ ਜਿੰਨੇ ਵੀ ਸਰਕਾਰੀ ਸਕੂਲ ਦੇ ਅਧਿਆਪਕਾਂ ਹਨ ਉਹਨਾਂ ਨੇ ਵਧੀਆ ਸਿੱਖਿਆ ਅਤੇ ਕੁ ਕੁਝ ਗੇਮਾਂ ਵੀ ਸਰਕਾਰੀ ਸਕੂਲਾਂ ਵਿੱਚ ਕਰਵਾਈਆਂ ਜਾਂਦੀਆਂ ਹਨ ਤਾਂ ਕਿ ਬੱਚਾ ਜਦੋਂ ਸਕੂਲ ਤੋਂ ਪੜ੍ਹ ਕੇ ਸਕੂਲ ਤੋਂ ਬਾਹਰ ਨਿਕਲੇ ਤਾਂ ਉਹ ਆਪਣੀ ਜ਼ਿੰਦਗੀ ਵਿੱਚ ਕੁਛ ਨਾ ਕੁਛ ਬਣ ਸਕੇ